ਮੈਂ ਧਾਰਮਿਕ ਅੰਧਵਿਸ਼ਵਾਸਾਂ ਬਾਰੇ ਇਹ ਸੋਚਦੀ ਹਾਂ ਕਿ ਲੋਕਾਂ ਨੇ ਪਖੰਡ ਫੜ ਰੱਖਿਆ ਹੈ ਜਿਹੜੇ ਪਖੰਡੀ ਸਾਧ ਨੇ ਡੇਰੇ ਚਲਾਏ ਹੋਏ ਨੇ ਆਪਣਾ ਸੁਆਰਥ ਭਾਲਦੇ ਨੇ ਇਹ ਲੋਕਾਂ ਤੋਂ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੁੱਟਦੇ ਨੇ ਭੋਲੇ ਭਾਲੇ ਲੋਕਾਂ ਤੋਂ ਸੋਨਾ ਲੁੱਟਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਨੇ ਤੁਹਾਡੇ ਕੰਮ ਬਣ ਜਾਣਗੇ ਇੱਦਾਂ ਹੋ ਜਾਉ ਉੱਦਾਂ ਹੋ ਜਾਉ ਅਤੇ ਲੋਕ ਜਿਹੜੇ ਭੋਲੇ ਭਾਲੇ ਨੇ ਉਹਨਾਂ ਦੇ ਝਾਂਸੇ ਦੇ ਵਿੱਚ ਆ ਕੇ ਆਪਣਾ ਸਭ ਕੁਛ ਲੁਟਾ ਦਿੰਦੇ ਨੇ ਇਹ ਅੰਧਵਿਸ਼ਵਾਸ ਹੈ ਅਸੀਂ ਇਹਨਾਂ 'ਤੇ ਵਿਸ਼ਵਾਸ ਕਰਦੇ ਹਾਂ ਅਤੇ ਕੋਈ ਇੱਦਾਂ ਦੀ ਡਿਮਾਂਡਾਂ ਕਰਦਾ ਹੈ ਇਹੋ ਜਿਹੇ ਢੌਂਗ ਬਾਬਿਆਂ ਦੇ ਅੱਗੇ ਜਾਂਦਾ ਹੈ ਕੋਈ ਕਹਿੰਦਾ ਹੈ ਮੈਨੂੰ ਪੁੱਤ ਮਿਲ ਜਾਵੇ ਕੋਈ ਕਹਿੰਦਾ ਹੈ ਮੈਨੂੰ ਨੌਕਰੀ ਮਿਲ ਜਾਵੇ ਕੋਈ ਕਹਿੰਦਾ ਹੈ ਮੇਰਾ ਕਾਰੋਬਾਰ ਵੱਧ ਜਾਵੇ ਕੋਈ ਕਹਿੰਦਾ ਹੈ ਮੇਰਾ ਵਿਆਹ ਹੋ ਜਾਵੇ ਕੋਈ ਕਹਿੰਦਾ ਹੈ ਮੇਰੇ ਬੱਚੇ ਹੋ ਜਾਵੇ ਅਤੇ ਮੇਰਾ ਕਹਿਣ ਦਾ ਭਾਵ ਹੈ ਇਹ ਸਭ ਕੁਛ ਜਿਹੜੇ ਪੈਸੇ ਗਹਿਣੇ ਗੱਟੇ ਓਹ ਬਾਬੇ ਲੁੱਟ ਲੈਂਦੇ ਨੇ ਉਹਨਾਂ ਕੋਲੋਂ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਵੀ ਅਸੀਂ ਤੁਹਾਡਾ ਇਹ ਕੰਮ ਕਰ ਦਾਂਗੇ ਇਹ ਕਰ ਕਰ ਦਾਂਗੇ ਪਰ ਨਹੀਂ ਅਤੇ ਇਹ ਕੰਮ ਇਹ ਬਾਬਿਆਂ ਕੋਲੋਂ ਨਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੋ ਆਪਣੇ ਮਹਾਨ ਗੁਰਗੱਦੀ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਅ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਣ ਵਾਸਤੇ ਗੁਰੂ ਮਾਨਿਓ ਗ੍ਰੰਥ ਕਿ ਇਹਨਾਂ ਦੇ ਅੱਗੇ ਤੁਸੀਂ ਸੀਸ ਝੁਕਾਓ ਇਹੀ ਸੱਚੇ ਗੁਰੂ ਨੇ ਇਹ ਦੁੱਧ ਵਾਲਿਆਂ ਨੂੰ ਦੁੱਧ ਅਤੇ ਪੁੱਤ ਵਾਲਿਆਂ ਨੂੰ ਪੁੱਤ ਦੀ ਪ੍ਰਾਪਤੀ ਹੁੰਦੀ ਨਹੀਂ ਇਹ ਦਰ ਐਸਾ ਹੈ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ਇਸ ਦਰ 'ਤੇ ਸਭ ਕੁਛ ਹਰ ਇੱਕ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਪਰ ਜੇ ਵਿਸ਼ਵਾਸ ਹੋਵੇ ਵਿਸ਼ਵਾਸ ਹੋਵੇ ਭਰੋਸਾ ਹੋਵੇ ਅਤੇ ਅਸੀਂ ਜਿਹੜਾ ਮਤਲਬ ਅਸੀਂ ਪਖੰਡ ਰਚਾਇਆ ਹੋਇਆ ਹੈ ਅਸੀਂ ਢੌਂਗ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਸਾਡਾ ਆਪਣਾ ਹੀ ਦਿਮਾਗ ਨਹੀਂ ਕੰਮ ਕਰਦਾ ਅਸੀਂ ਜਾ ਕੇ ਆਪਣਾ ਸਭ ਕੁਛ ਲੁਟਾ ਦਿੰਦੇ ਹੈ ਪਰ ਕਿਸੇ ਕਵੀ ਨੇ ਕਿਹਾ ਕਹਿੰਦੇ ਜਿਸ ਨੂੰ ਤੂੰ ਜੰਗਲਾਂ ਵਿੱਚ ਲੱਭਦਾ ਹੈ ਵਿੱਚ ਵਸਦਾ ਤੇਰੇ ਇੱਕ ਮਨ ਹੋ ਕੇ ਭਗਤੀ ਕਰ ਲੈ ਕਿਉਂ ਫਿਰਦਾ ਹੈ ਵਿੱਚ ਹਨੇਰੇ ਕਹਿੰਦਾ ਬੰਦਿਆ ਤੂੰ ਐਵੇਂ ਭਟਕੀ ਜਾਂਦਾ ਹੈ ਜੇ ਪਾਉਣਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲੋਂ ਪਾ ਜੇ ਝੋਲੀ ਅੱਡਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਝੋਲੀ ਅੱਡ ਅਤੇ ਕਹਿਣ ਦਾ ਭਾਵ ਹੈ ਜਿਹੜੇ ਢੌਂਗ ਬਾਬੇ ਨੇ ਇਹਨਾਂ ਨੇ ਪਾਖੰਡ ਰਚਾਇਆ ਹੋਇਆ ਕਲਗੀਧਰ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋ ਸਕਦਾ ਲੋਕਾਂ ਨੂੰ ਇਹਨਾਂ ਮੁੱਦਿਆਂ ਦੇ ਨਾਲ ਕਿਵੇਂ ਨਜਿੱਠਣਾ ਚਾਹੀਦਾ ਮੇਰਾ ਮੰਨਣਾ ਇਹ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਆਪਾਂ ਸੀਸ ਨਿਭਾਈਏ ਉਹਨਾਂ ਦੇ ਅੱਗੇ ਆਪਾਂ ਆਪਣੀ ਜੋਦਰੀ ਅਰਦਾਸ ਬੇਨਤੀ ਕਰੀਏ ਅਤੇ ਉਹਨਾਂ ਅੱਗੇ ਆਪਣੀ ਝੋਲੀ ਫਰੋਲੀਏ ਉਹ ਸਭ ਦਾ ਦਾਤਾ ਹੈ ਅਤੇ ਉਹ ਕਹਿੰਦੇ ਨੇ ਕਹਿੰਦੇ ਬੰਦਾ ਮੰਗਦਾ ਮੰਗਦਾ ਨਹੀਂ ਥੱਕਦਾ ਅਤੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਦਿੰਦਾ ਦਿੰਦਾ ਨਹੀਂ ਥੱਕਦਾ ਇਸ ਕਰਕੇ ਆਪਣਾ ਵਿਸ਼ਵਾਸ ਅਟੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ ਰੱਖੀਏ